ਕਈ ਸਾਲਾਂ ਤੋਂ ਚਲੀ ਆ ਰਹੀ ਫੋਟੋਗਰਾਫੀ ਵਿੱਚ ਕਾਫੀ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਹਨ ਪੁਰਾਣੇ ਕੈਮਰਿਆਂ ਨਾਲੋਂ ਨਵੇਂ ਮੋਬਾਈਲ ਕੈਮਰਿਆਂ ਵਿੱਚ ਬਹੁਤ ਅੰਤਰ ਹੈ ਪੁਰਾਣੇ ਕੈਮਰਿਆਂ ਵਿੱਚ ਫੋਟੋ ਜਾਂ ਵੀਡੀਓ ਦੀ ਕੁਆਲਿਟੀ ਇੰਨੀ ਵਧੀਆ ਨਹੀਂ ਸੀ ਹੁੰਦੀ ਪ੍ਰੰਤੂ ਅੱਜ ਕੱਲ੍ਹ ਦੇ ਮੋਬਾਇਲ ਫੋਨਾਂ ਵਿੱਚ ਸਲੋ ਮੋਸ਼ਨ ਵੀਡੀਓ

ਐਚ ਡੀ ਫੋਟੋ ਹੋਣ ਕਾਰਨ ਕੈਮਰਿਆਂ ਵਿੱਚ ਕਈ ਤਬਦੀਲੀਆਂ ਆ ਗਈਆਂ ਹਨ ਅਤੇ ਇਹ ਸਾਡੇ ਲਈ ਹੁਣ ਇੱਕ ਸੌਖਾ ਸਾਧਨ ਬਣ ਗਿਆ ਹੈ